ਪੰਜਾਬ ਵਿੱਚ ਸਰਕਾਰ ਉੱਦਮਤਾ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੀਆਂ ਗਈਆਂ ਵੱਖ ਵੱਖ ਪਹਿਲਕਦਮੀਆਂ ਰਾਹੀਂ ਛੋਟੇ ਕਾਰੋਬਾਰਾਂ ਦਾ ਸਮਰਥਨ ਕਰਦੀ ਹੈ ਪੰਜਾਬ ਮੁੱਖ ਮੰਤਰੀ ਯੁਵਾ ਸਵੈ ਰੁਜ਼ਗਾਰ ਯੋਜਨਾ ਇਕ ਮਹੱਤਵਪੂਰਨ ਪ੍ਰੋਗਰਾਮ ਹੈ ਜਿਸ ਦਾ ਉਦੇਸ਼ ਨੌਜਵਾਨ ਉੱਦਮੀਆਂ ਨੂੰ ਵਿੱਤੀ ਸਹਾਇਤਾ ਅਤੇ ਸਿਖਲਾਈ ਪ੍ਰਦਾਨ ਕਰਕੇ ਉਤਸ਼ਾਹਿਤ ਕਰਨਾ ਹੈ ਇਹ ਸਕੀਮ ਛੋਟੇ ਕਾਰੋਬਾਰਾਂ ਨੂੰ ਸ਼ੁਰੂ ਕਰਨ ਜਾਂ ਵਧਾਉਣ ਵਿੱਚ ਮਦਦ ਕਰਨ ਲਈ ਸਬਸੀਡੀਆਂ ਅਤੇ ਕਰਜ਼ੇ ਦੀ ਪੇਸ਼ਕਸ਼ ਕਰਦੀ ਹੈ ਨੌਜਵਾਨਾਂ ਨੂੰ ਰੁਜ਼ਗਾਰ ਸਿਰਜਣ ਅਤੇ ਸਵੈ ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਨਿਸ਼ਾਨਾ ਬਣਾਉਂਦੀ ਹੈ ਇਸ ਤੋਂ ਇਲਾਵਾ ਉਦਯੋਗਿਕ ਪ੍ਰੇਰਨਾ ਮੁਹਿੰਮ ਵਰਕਸ਼ਾਪਾਂ ਸੈਮੀਨਾਰਾਂ ਅਤੇ ਪ੍ਰੇਰਿਕ ਵਰ ਵਰਤਾਵਾਂ ਦਾ ਆਯੋਜਨ ਕਰਕੇ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਇਹ ਸਮਾਗਮ ਸੰਭਾਵੀ ਉੱਦਮੀਆਂ ਨੂੰ ਵਪਾਰਕ ਮੌਕਿਆਂ ਵਿੱਤੀ ਪ੍ਰਬੰਧਨ ਅਤੇ ਛੋਟੇ ਉਦਯੋਗ ਸਾਬਤ ਕਰਨ ਦੇ ਲਾਭਾਂ ਬਾਰੇ ਸਿੱਖਿਅਤ ਕਰਨ ਲਈ ਲੋੜੀਂਦੇ ਲਈ ਤਿਆਰ ਕੀਤੇ ਗਏ ਹਨ ਆਈ ਐਮ ਸੀ ਰੈਗੂਲੇਟਰੀ ਪ੍ਰਕਿਰਿਆ ਨੂੰ ਸੌਖਾ ਬਣਾਉਣ ਲੋੜੀਂਦੇ ਲਾਈਸੈਂਸ ਪ੍ਰਾਪਤ ਕਰਨ ਲਈ ਮਾਰਗਦਰਸ਼ਨ ਪਰ ਪ੍ਰਦਾਨ ਕਰਨ ਅਤੇ ਉੱਦਮੀਆਂ ਨੂੰ ਵਿੱਤੀ ਸੰਸਥਾਵਾਂ ਨਾਲ ਜੋੜਨ ਵਿੱਚ ਵੀ ਮਦਦ ਕਰਦਾ ਹੈ ਇਕੱਠੇ ਮਿਲ ਕੇ ਇਹ ਪ੍ਰੋਗਰਾਮ ਛੋਟੇ ਕਾਰੋਬਾਰਾਂ ਲਈ ਇੱਕ ਸਹਾਇਕ ਇਕੋਸਿਸਟਮ ਬਣਾਉਣ ਉਹਨਾਂ ਦੀਆਂ ਵਿੱਤੀ ਅਤੇ ਵਿੱਦਿਅਕ ਲੋੜਾਂ ਨੂੰ ਪੂਰਾ ਕਰਨ ਅਤੇ ਰਾਜ ਵਿੱਚ ਸਮੁੱਚੀ ਆਰਥਿਕ ਤਰੱਕੀ ਨੂੰ ਚਲਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ